ਹੈਲੋ ਹਾਂਜੀ ਪਰਮਿੰਦਰ ਸਿੰਘ ਜੀ ਹਾਂਜੀ ਬਹੁਤ ਵਧੀਆ ਸਰ ਠੀਕ ਠਾਕ ਜੀ ਹੋਰ ਸੁਣਾਓ ਚਲੋ ਬਸ ਜੀ ਬਸ ਸਭ ਸ਼ਹਿਰ ਸੀ ਇੱਥੇ ਹੀ ਅੱਜ ਹੁਣ ਬਸ ਆ ਬਾਜ਼ਾਰ ਦੇ ਵਿੱਚੋਂ ਲੰਘ ਕੇ ਘਰ ਆਏ ਹਾਂ ਟਰੈਫਿਕ ਬਹੁਤ ਓਕੇ ਓਕੇ ਬਸ ਉਹ ਟਰੈਫਿਕ ਹੀ ਬਹੁਤ ਜ਼ਿਆਦਾ ਜੀ ਮੈਂ ਵੀ ਹੁਣ ਇਹ ਟਰੈਫਿਕ ਦੇ ਵਿੱਚੋਂ ਮਸਾਂ ਹੀ ਲੰਘ ਕੇ ਆਇਆ ਜੀ ਅੱਛਾ ਅੱਛਾ ਨਹੀਂ ਨਹੀਂ ਮੈਂ ਸਰ ਤੁਸੀਂ ਮੈਂ ਉਪਰੋਂ ਪੁਲ ਵਿੱਚ ਦੀਓ ਆ ਗਿਆ ਜੀ ਤੁਸੀਂ ਥੱਲੇ ਹੋਵੋਗੇ ਪੁੱਲ ਦੇ ਅੱਛਾ ਅੱਛਾ ਨਹੀਂ ਨਹੀਂ ਮੈਂ ਫਿਰ ਪੁੱਲ ਉੱਤੋਂ ਦੀ ਤਾਂ ਥੋੜ੍ਹਾ ਜਿਹਾ ਜਲਦੀ ਆ ਗਿਆ ਲੇਕਿਨ ਰਸ਼ ਪੁੱਲ 'ਤੇ ਵੀ ਬਹੁਤ ਜ਼ਿਆਦਾ ਸੀ ਰਸ਼ ਹਾਂ ਉਹ ਉਹਦੇ ਕਰਕੇ ਹੈ ਸਰ ਪਾਰਕਿੰਗ ਦੀ ਹੀ ਮੇਨ ਸਮੱਸਿਆ ਹੈ ਬਾਜ਼ਾਰਾਂ ਦੇ ਵਿੱਚ ਆਪਣੀ ਕਿਹਾ ਵਾਹਨ ਜਿਹੜੀ ਜੋ ਲਾਲ ਲਕੀਰ ਆ ਉਸ ਤੋਂ ਬਾਹਰ ਕਿੰਨੇ ਕਿੰਨੇ ਆ ਚੁੱਕੇ ਹੈ ਬਿਲਕੁਲ ਜੀ ਬਿਲਕੁਲ ਲਾ ਦਿੰਦੇ ਹੈਗੇ ਟਰੈਫਿਕ ਵਾਲੇ ਵੀ ਮੈਂ ਦੇਖਿਆ ਜੀ ਬਹੁਤ ਉਹਨਾਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਉਹ ਵਿਚਾਰੇ ਵੀ ਜਦੋਂ ਆਉਂਦੇ ਨੇ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਆ ਅੰਦਰ ਕਰਵਾਉਣ ਦੀ ਚਲਾਨ ਵੀ ਕੱਟੇ ਉਹਨਾਂ ਨੇ ਪਰ ਆਪਣੀ ਥੋੜ੍ਹੀ ਜਿਹੀ ਜਨਤਾ 'ਚ ਹਾਂਜੀ ਹਾਂ ਥੋੜ੍ਹਾ ਜਿਹਾ ਆਪਣੇ 'ਚ ਵੀ ਇਹ ਗਲਤੀ ਆ ਨਾ ਜੀ ਜਿੰਮੇਵਾਰ ਨਾਗਰਿਕ ਹਾਲੇ ਨਹੀਂ ਹੈਗੇ ਵਿੱਚੋਂ ਕਹੀਏ ਨਹੀਂ ਸਮਝਦੇ ਇਹਨਾਂ ਸਮੱਸਿਆਵਾਂ ਨੂੰ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਰੈਸ਼ ਬਾਕੀ ਸਰ ਡਰਾਈਵਿੰਗ ਹੈ ਜੀ ਅੱਜ ਕੱਲ੍ਹ ਪੂਰੀ ਰੈਸ਼ ਕਰਦੇ ਆ ਬਾਕੀ ਬੱਚੇ ਹੈ ਜੀ ਅਣਜਾਣ ਜਿਹੜੇ ਛੋਟੀ ਉਮਰ ਵਾਲੇ ਅਤੇ ਹੂੰ ਹਾਂਜੀ ਹਾਂਜੀ ਬਾਕੀ ਸਰਕਾਰ ਵੱਲੋਂ ਪੁੱਲ ਵਗੈਰਾ ਤਾਂ ਬਹੁਤ ਸਰਕਾਰ ਵੱਲੋਂ ਪੁੱਲ ਵਗੈਰਾ ਦੇਖੋ ਬਣਾਏ ਗਏ ਨੇ ਲੇਕਿਨ ਵੱਧਦੀ ਜਾਣ ਵਾਲੀ ਪਾਪੂਲੇਸ਼ਨ ਹੈ ਜੀ ਉਹਦੇ ਅਕੋਰਡਿੰਗ ਇਹ ਪੁੱਲ ਵੀ ਲੱਗਦਾ ਵੀ ਘੱਟ ਹੀ ਪੈ ਰਹੇ ਨੇ ਅਤੇ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਠੀਕ ਠੀਕ ਠੀਕ ਸਰ ਜ਼ਰੂਰ ਜੀ ਜ਼ਰੂਰ ਬਾਕੀ ਫਿਰ ਬਾਅਦ 'ਚੋਂ ਮਿਲਦੇ ਹਾਂ ਓਕੇ ਜੀ ਓਕੇ